ਹਾਂਜੀ ਸਾਡੀ ਜ਼ਿੰਦਗੀ ਦੇ ਮਹੱਤਵਪੂਰਨ ਸਬਕ ਇਹ ਹਨ ਕਿ ਵੱਡਿਆ ਨੂੰ ਆਦਰ ਅਤੇ ਛੋਟਿਆਂ ਨੂੰ ਪਿਆਰ ਇਹ ਸਭ ਤੋਂ ਜ਼ਰੂਰੀ ਹੈ ਅਤੇ ਦੂਜੀ ਗੱਲ ਇਹ ਹੈ ਕਿ ਹਰ ਕੋਈ ਜੇ ਐਂਵੇਂ ਕਹੇ ਨਾ ਵੀ ਲੜਕੀ ਕਹਿੰਦੀ ਵੀ ਹਾਂ ਮੇਰੇ ਮਾਂ ਬਾਪ ਨੇ ਕਦੇ ਮੈਨੂੰ ਝਿੜਕਿਆ ਨਹੀਂ ਹੈਗਾ ਮਾਰਿਆ ਨਹੀਂ ਹੈਗਾ ਵੀ ਬਹੁਤ ਪਿਆਰ ਨਾਲ਼ ਰੱਖਿਆ ਜੇ ਸੋਚਿਆ ਜਾਵੇ ਕਿ ਵਿਆਹ ਤੋਂ ਬਾਅਦ ਆਪਾਂ ਜਿਹੜੇ ਘਰ ਜਾਂਦੇ ਉਹ ਵੀ ਆਪਾਂ ਨੂੰ ਉਵੇਂ ਹੀ ਰੱਖਦੇ ਹਨ ਅਤੇ ਜਿਵੇਂ ਕਿ ਆਪਣੇ ਪੇਕੇ ਰੱਖਦੇ ਪਰ ਜੇ ਗ਼ਲਤੀ ਆਪਣੇ ਪੇਕਿਆਂ ਵਿੱਚ ਕਰੀ ਹੈ ਤਾਂ ਉਹਦੀ ਝਿੜਕ ਤਾਂ ਆਪਾਂ ਨੂੰ ਮਾਂ ਬਾਪ ਨੇ ਵੀ ਮਾਰੀ ਹੈ ਜੇ ਹੁਣ ਕੋਈ ਗ਼ਲਤੀ ਆਪਾਂ ਉੱਥੇ ਕਰੂੰਗੇ ਉਨ੍ਹਾਂ ਦਾ ਵੀ ਝਿੜਕਣ ਦਾ ਅਤੇ ਕਹਿਣ ਦਾ ਪੂਰਾ ਹੱਕ ਹੈ ਪਰ ਇੱਕ ਗੱਲ ਇਹ ਹੈ ਕਿ ਜਿੰਨਾਂ ਆਪਾਂ ਆਪਣੇ ਪੇਕੇ ਘਰ ਨੂੰ ਪਿਆਰ ਕਰਦੇ ਹਾਂ ਉਨ੍ਹਾਂ ਹੀ ਸੋਹਰੇ ਪਰਿਵਾਰ ਨੂੰ ਵੀ ਕਰਨਾ ਚਾਹੀਦਾ ਅਤੇ ਉਹਨਾਂ ਦਾ ਜਿੰਨਾਂ ਪਿਆਰ ਆਪਾਂ ਨੂੰ ਚਾਹੀਦਾ ਏ ਉਹਨਾਂ ਜ਼ਰੂਰ ਦਿਉ ਸਬਕ ਇਹ ਨਹੀਂ ਹੈਗਾ ਵੀ ਹਾਂ ਆਪਾਂ ਨੇ ਜੋ ਪੜ੍ਹ ਲਿਆ ਉਹ ਹੀ ਸਬਕ ਹੋ ਸਬਕ ਜ਼ਿੰਦਗੀ 'ਚ ਬਹੁਤ ਹੈ ਆਪਾਂ ਨੂੰ ਦਿਨ ਪਰ ਦਿਨ ਨਵੇਂ ਤੋਂ ਨਵਾਂ ਸਬਕ ਸਿੱਖਣ ਨੂੰ ਮਿਲਦਾ ਜੇ ਹੁਣ ਆਪਾਂ ਕਹੀਏ ਆਪਾਂ ਸਵੇਰੇ ਉੱਠ ਕੇ ਸ਼ਾਮ ਤੱਕ ਜਿੰਨੇ ਕੰਮ ਕਰਦੇ ਉਹਦੇ ਵਿੱਚ ਕੁਝ ਗ਼ਲਤ ਵੀ ਹੈ ਅਤੇ ਜੇ ਕੋਈ ਆਪਾਂ ਨੂੰ ਗ਼ਲਤ ਕਹਿ ਕੇ ਉਹ ਕੰਮ ਸਹੀ ਕਰਾਉਂਦਾ ਉਹ ਵੀ ਆਪਣੇ ਖਾਤਰ ਇੱਕ ਤਰ੍ਹਾਂ ਦਾ ਸਬਕ ਹੀ ਹੈ ਸਬਕ ਕਿਤਾਬਾਂ ਤੋਂ ਇਲਾਵਾ ਆਪਾਂ ਨੂੰ ਆਪਣੀ ਜ਼ਿੰਦਗੀ 'ਚ ਬਹੁਤ ਵਾਰ ਮਿਲਦਾ ਏ ਅਤੇ ਜਿਹਨੂੰ ਆਪਾਂ ਨੂੰ ਮੰਨਣਾ ਵੀ ਪੈਂਦਾ ਹੈ ਹਰ ਰਿਸ਼ਤੇ ਨੂੰ ਮਹੱਤਤਾ ਦੇਣੀ ਚਾਹੀਦੀ ਹੈ ਪਿਆਰ ਦੇਣਾ ਚਾਹੀਦਾ ਹੈ ਤਾਂ ਕਿ ਜਿਸ ਨਾਲ਼ ਨਾ ਤਾਂ ਕਿਸੇ ਦਾ ਸਿਰ ਉ ਨੀਵਾਂ ਨਾ ਹੋਵੇ ਸਦਾ ਉੱਚਾ ਹੀ ਰਹੇ ਇਹ ਦੇ ਨਾਲ਼ ਇੱਕ ਆਪਣਾ ਹੀ ਨਹੀਂ ਆਪਣੇ ਦੇਸ਼ ਦਾ ਵੀ ਬਹੁਤ ਸਫ਼ਲਤਾ ਮਿਲਦੀ ਹੈ ਬਹੁਤ ਇਹਦੇ ਨਾਲ਼ ਵੀ ਨਾਮ ਹੁੰਦਾ ਵੀ ਇਹ ਜੋ ਵੀ ਹੋ ਰਿਹਾ ਹੈ ਵਧੀਆ ਹੀ ਹੈ ਸਬਕ ਸਭ ਤੋਂ ਵੱਡਾ ਸੁੱਖ ਹੈ ਇਹ ਸੁੱਖ ਨੂੰ ਸਾਂਭ ਕੇ ਹੀ ਰੱਖਣਾ ਚਾਹੀਦਾ ਹੈ ਧੰਨਵਾਦ